ਮੈਂ ਯੂਟਿਊਬ ਤੋਂ ਜਾਂ ਟੀ ਵੀ ਸ਼ੋਜ਼ ਤੋਂ ਵੇਖ ਕੇ ਵੱਖ ਵੱਖ ਤਰੀਕੇ ਦੀਆਂ ਡਿਸ਼ਿਜ਼ ਬਣਾਉਣੀ ਹਾਂ ਮੈਨੂੰ ਇਹ ਕੰਮ ਕਰਨਾ ਬਹੁਤ ਚੰਗਾ ਲੱਗਦਾ ਹੈ ਯੂਟੀਊਬ ਤੋਂ ਸੰਜੀਵ ਕਪੂਰ ਦੀਆਂ ਵੀਡੀਓਜ ਅਤੇ ਟੀ ਵੀ ਸ਼ੋ ਮਾਸਟਰ ਸ਼ੈਫ ਇੰਡੀਆ ਵੇਖਣਾ ਮੈਨੂੰ ਬਹੁਤ ਪਸੰਦ ਹੈ ਜਦੋਂ ਵੀ ਮੈਨੂੰ ਟਾਈਮ ਲੱਗਦਾ ਹੈ ਮੈਂ ਨਵੇਂ ਨਵੇਂ ਤਰੀਕੇ ਦੇ ਭੋਜਨ ਬਣਾ ਕੇ ਆਪਣੇ ਘਰਦਿਆਂ ਨੂੰ ਖਿਲਾਉਂਦੀ ਹਾਂ ਉਹਨਾਂ ਨੂੰ ਵੀ ਉਹ ਖਾਣਾ ਬਹੁਤ ਚੰਗਾ ਲੱਗਦਾ ਹੈ ਜਿਸ ਤਰੀਕੇ ਨਾਲ ਸੰਜੀਵ ਕਪੂਰ ਆਪਣੀ ਵੀਡੀਓਜ਼ 'ਚ ਖਾਣ ਬਾਰੇ ਦੱਸਦਾ ਹੈ ਕਿ ਕਿਸ ਤਰੀਕੇ ਨਾਲ ਖਾਣਾ ਬਣਾਉਣਾ ਹੈ ਉਹ ਬਹੁਤ ਹੀ ਸਰਲ ਹੈ ਅਤੇ ਉਸ ਨੂੰ ਫੋਲੋ ਕਰ ਕੇ ਖਾਣਾ ਬਣਾਉਣਾ ਵੀ ਬਹੁਤ ਸੌਖਾ ਹੈ ਇਸ ਕਰਕੇ ਮੈਨੂੰ ਖਾਣਾ ਬਣਾਉਣਾ ਬਹੁਤ ਪਸੰਦ ਲੱਗਦਾ ਹੈ